ਹੈਲੋ ਸਰ ਅਸੀਂ ਤੁਹਾਡੀ ਕੈਬ ਬੁੱਕ ਕਰੀ ਸੀ ਜੋ ਹਾਲੇ ਤੱਕ ਪਹੁੰਚੀ ਨਹੀਂ ਔਰ ਅਸੀਂ ਜਲਦੀ ਪਹੁੰਚਣਾ ਸੀ ਜਿੱਥੇ ਜਾਣਾ ਸੀ ਹੋਸਪਿਟਲ ਪਹੁੰਚਣਾ ਸੀ ਅਸੀਂ ਜਰੂਰੀ ਅਜੇ ਤੱਕ ਤੁਹਾਡੀ ਕੈਬ ਨਹੀਂ ਆਈ ਔਰ ਅਸੀਂ ਬਹੁਤ ਟਾਈਮ ਵੇਸਟ ਹੋ ਚੁੱਕਿਆ ਵੇਟ ਕਰਦੇ ਕਰਦੇ ਅਗਰ ਤੁਸੀਂ ਆਉਣਾ ਤਾਂ ਵੀ ਦੱਸੋ ਨਹੀਂ ਆਉਣਾ ਤਾਂ ਵੀ ਦੱਸੋ ਨਹੀਂ ਤਾਂ ਅਸੀਂ ਦੂਸਰੀ ਕੈਬ ਬੁੱਕ ਕਰ ਲਈਏ ਸਾਨੂੰ ਬਹੁਤ ਜਰੂਰੀ ਜਾਣਾ ਹੈ ਸਾਡਾ ਕੋਈ ਮਤਲਬ ਐਡਮਿਟ ਹੈ ਹੋਸਪਿਟਲ ਵਿੱਚ ਉਸਦਾ ਪਤਾ ਲੈਣ ਜਾਣਾ ਸੀ ਤਾਂ ਇਸ ਕਰਕੇ ਅਗਰ ਤੁਸੀਂ ਆ ਸਕਦੇ ਹੋ ਤਾਂ ਆ ਜਾਓ ਅਗਰ ਨਹੀਂ ਆ ਸਕਦੇ ਤਾਂ ਸਾਨੂੰ ਦੱਸ ਦਿਓ ਅਸੀਂ ਕੋਈ ਹੋਰ ਕੈਬ ਵਾਲੇ ਨੂੰ ਬੁਲਾ ਲਈਏ ਕਿਉਂਕਿ ਸਾਡੇ ਕੋਲ ਹੋਰ ਟਾਈਮ ਨਹੀਂ ਹੈ ਅਸੀਂ ਕਿਤੇ ਹੋਰ ਵੀ ਜਾਣਾ ਹੈ